ਇਸ ਵਿੱਚ ਪਾਰਟੀਆਂ ਅਤੇ ਉਮੀਦਵਾਰਾਂ ਨੇ ਆਪਣੇ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਰੈਲੀਆਂ ਜਨਤਾ ਮੀਟਿੰਗਾਂ ਦਰਵਾਜਿਆਾਂ ਤੋਂ ਦਰਵਾਜਾ ਪ੍ਰਚਾਰ ਕਰਨ ਦੀ ਲੋੜ ਹੁੰਦੀ ਹੈ ਲੋਕਾਂ ਨੂੰ ਨੀਤੀਆਂ ਅਤੇ ਵਿਚਾਰ ਸਮਝਣ ਲਈ ਮੀਡੀਆ ਜਿਵੇਂ ਕਿ ਟੀਵੀ ਅਖਬਾਰਾਂ ਅਤੇ ਸੋਸ਼ਲ ਮੀਡੀਆ ਵੀ ਪ੍ਰਚਾਰ ਕਰਦਾ ਹੈ ਵੋਟਿੰਗ ਦਿਨਾਂ ਨੂੰ ਦਿਨ ਨੂੰ ਲੋਕਾਂ ਨੂੰ ਵੋਟ ਪੇਸ਼ ਕਰਨੀ ਉਮੀਦਵਾਰਾਂ ਨੂੰ ਵੋਟਿੰਗ ਬੂਥਾਂ ਦੇ ਕੋਲ ਆਉਣ ਵਾਸਤੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਇੱਥੋਂ ਦੀ ਸਰਕਾਰ ਹਰ ਪੰਜ ਸਾਲ ਬਾਅਦ ਹੋਈਆਂ ਵੋਟਾਂ ਦੇ ਮਾਧਿਅਮ ਤੋਂ ਚੁਣੀ ਜਾਂਦੀ ਹੈ ਦੇਸ਼ ਦੇ ਨਾਗਰਿਕ ਇਸ ਚੁਣਾਵੀ ਪ੍ਰਕਿਰਿਆ ਵਿੱਚ ਸਿੱਧੇ ਤੌਰ 'ਤੇ ਹਿੱਸਾ ਲੈਂਦੇ ਹਨ ਭਾਰਤ ਦੇ ਸੰਵਿਧਾਨ ਅਨੁਸਾਰ ਦੇਸ਼ ਵਿੱਚ ਨਿਯਮਤ ਆਜ਼ਾਦੀ ਹੈ ਨਿਸ਼ਪਕਸ਼ ਚੁਣਾਵ ਆਯੋਜਿਤ ਕਰਨ ਦਾ ਅਧਿਕਾਰ ਨਿਰਵਾਚਨ ਆਯੋਗ ਨੂੰ ਪ੍ਰਾਪਤ ਹੈ ਜੇਕਰ ਕਿਸੇ ਵੀ ਨਾਗਰਿਕ ਦਾ ਮਤਦਾਨ ਸੂਚੀ ਵਿੱਚੋਂ ਕੋਈ ਵੀ ਵਿਵਰਨ ਗਲਤ ਦਰਜ ਹੈ ਜਿਵੇਂ ਕਿ ਨਾਮ ਪਤਾ ਜਾਂ ਉਮਰ ਆਦਿ ਤਾਂ ਉਹ ਇਸਨੂੰ ਸਹੀ ਕਰਵਾਉਣ ਲਈ ਬੇਨਤੀ ਕਰ ਸਕਦੇ ਹਨ